ਆਹ ਜਿਹੜਾ ਪੈੱਨ ਹੈ ਨਾ ਪਾਰਕਰ ਦਾ ਬੜਾ ਸੋਹਣਾ ਲੱਗਿਆ ਮੈਨੂੰ ਮੈਂ ਪਿਛਲੇ ਹਫਤੇ ਬੈਠਾ ਆਪਣੇ ਫਰੈਂਡ ਦੇ ਘਰ ਔਨਲਾਈਨ ਅਸੀਂ ਨਾ ਫਲਿੱਪਕਾਟ 'ਤੇ ਦੇਖਣ ਲੱਗ ਗਏ ਚੀਜ਼ਾਂ ਅਤੇ ਦੇਖਦੇ ਦੇਖਦੇ ਉਹ ਮੈਨੂੰ ਚਲੋ ਸ਼ਾਇਰੀ ਮੈਂ ਲਿਖਦਾ ਡਾਇਰੀ ਮੇਰੇ ਕੋਲ ਹੁੰਦੀ ਆ ਅਤੇ ਮੈਂ ਇਸ ਕਰਕੇ ਮੈਂ ਕਿਹਾ ਚਲੋ ਪੈੱਨ ਰੱਖਣ ਦਾ ਮੈਨੂੰ ਸ਼ੌਕ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਮੇਰੇ ਕੋਲ ਘੱਟੋ ਘੱਟ ਵੀਹ ਤੋਂ ਪੱਚੀ ਪੈੱਨ ਪਏ ਹੋਣੇ ਮੇਰੇ ਘਰ ਜਿਹੜੀ ਮਿਨੀ ਲਾਈਬ੍ਰੇਰੀ ਬਣਾਈ ਹੋਈ ਆ ਅਤੇ ਫਿਰ ਉਹਨਾਂ ਵਿੱਚੋਂ ਮੈਨੂੰ ਨਾ ਪੈੱਨ ਜਦੋਂ ਮੈਂ ਦੇੇਖਿਆ ਇਹਦੀ ਕੋਸਟ ਸੀਗੀ ਸਾਢੇ ਪੰਜ ਸੌ ਰੁਪਇਆ ਪਰ ਮੈਨੂੰ ਲੱਗਾ ਇੱਕ ਵਾਰ ਤਾਂ ਵੀ ਬਹੁਤ ਜ਼ਿਆਦਾ ਨੇ ਚੱਲ ਮੈਂ ਨਾਲ ਦੇ ਦੋਸਤ ਨੂੰ ਕਿਹਾ ਚੱਲ ਤੂੰ ਦੇ ਦੀ ਯਾਰ ਵੀ ਸੌ ਕੁ ਰੁਪਇਆ ਘੱਟਦਾ ਜੋ ਉਹਨੇ ਪਾਤੇ ਵੀ ਚੱਲ ਆਪਾਂ ਯਾਰ ਮੰਗਵਾ ਲੈਂਦੇ ਹਾਂ ਚੱਲ ਸਾਡੇ ਕੋਲ ਅੱਜ ਹਾਲੇ ਰਸੀਵ ਕਰਿਆ ਹਾਲੇ ਜਦ ਮੈਂ ਦੇਖਿਆ ਮੈਂ ਵੱਡੇ ਭਾਈ ਨੂੰ ਦਿਖਾਇਆ ਉਹਨੂੰ ਪਸੰਦ ਏ ਬਹੁਤ ਆਇਆ ਪੈੱਨ ਅਤੇ ਪੈੱਨ ਦਾ ਰੰਗ ਹੈਗਾ ਉਨਾਬੀ ਜਿਹੜਾ ਕਿ ਮੇਰਾ ਫੇਵਰੇਟ ਕਲਰ ਹੈ ਅਤੇ ਜਦੋਂ ਮੈਂ ਚਲਾ ਕੇ ਦੇਖਿਆ ਇਹ ਤਾਂ ਐਂ ਲਿਖਦਾ ਜਿਵੇਂ ਮੋਤੀ ਪਰੋਏ ਜਾ ਰਹੇ ਹੋਣ ਅਤੇ ਬਾਈ ਨੇ ਵੀ ਬੜੀ ਤਰੀਫ ਕਰੀ ਹੋਰ ਤਾਂ ਹੋਰ ਬਾਈ ਨੇ ਤਾਂ ਮੈਨੂੰ ਕਿਹਾ ਤੂੰ ਪੈੱਨ ਏ ਮੈਨੂੰ ਦੇ ਦੇ ਮੈਂ ਕਿਹਾ ਚੱਲ ਭਾਈ ਲੈ ਲਾ ਹੁਣ ਆਪਣਾ ਪਿਆਰ ਹੈ ਫੇਰ ਇਸ ਕਰਕੇ ਹੁਣ ਮੈਂ ਕਿਹਾ ਚੱਲ ਤੂੰ ਰੱਖ ਲਾ ਆਪਾਂ ਇੱਕ ਹੋਰ ਮੰਗਾਵਾਂਗੇ ਕਿਉਂਕਿ ਪੈੱਨ ਤਾਂ ਜੀ ਸਾਡੇ ਕੋਲ ਹੁਣ ਅਸੀਂ ਗਹਿਣਿਆਂ ਵਾਂਗੂ ਰੱਖਦੇ ਹਾਂ ਵਿਦਿਆਰਥੀ ਵੀ ਹਾਂ ਅਤੇ ਦੂਜਾ ਉੱਪਰੋਂ ਸ਼ਾਇਰੀ ਲਿਖਦੇ ਹਾਂ ਤੀਜਾ ਕਿਤਾਬਾਂ ਪੜ੍ਹਨ ਦਾ ਸ਼ੌਕ ਫੇਰ ਪੈੱਨ ਤਾਂ ਜਿੰਨੇ ਵੱਧ ਤੋਂ ਵੱਧ ਹੋਣ ਓਨੇ ਚੰਗੇ ਨੇ ਫਿਰ ਮੈਨੂੰ ਸੈਲਫ ਡੈਰੀ ਲਿਖਣ ਦਾ ਸ਼ੌਕ ਹੈ ਜਿਹਦੇ ਕਰਕੇ ਮੈਂ ਪੰਜ ਤੋਂ ਦੱਸ ਪੇਜ ਊਂ ਲਿਖਣੇ ਹੁੰਦੇ ਨੇ ਅਤੇ ਉਹ ਵੀ ਮੈਂ ਹਲਕੇ ਪੈੱਨ ਨਾਲ ਨਹੀਂ ਲਿਖਦਾ ਜਿਹੜਾ ਮੇਰਾ ਫੇਵਰੇਟ ਪੈੱਨ ਹੋਵੇ ਉਹੀ ਫੇਵਰੇਟ ਸ਼ਾਇਰੀ ਮੈਂ ਆਪਣੀ ਡਾਇਰੀ 'ਤੇ ਲਿਖਦਾ ਬਸ ਇਹੀ ਆ ਜੀ